ਹਾਂਜੀ ਹੈਲੋ ਹਾਂਜੀ ਮੈਂ ਸਪੋਰਟਸ ਟੀਚਰ ਬੋਲ ਰਹੀ ਹਾਂ ਤੁਸੀਂ ਕਿੱਥੋਂ ਬੋਲ ਰਹੇ ਹੋ ਹਾਂਜੀ ਹਾਂਜੀ ਦੇਖੋ ਦੀਦੀ ਬੇਸਿਕਲੀ ਐਵੇਂ ਹੁੰਦਾ ਹਾਂਜੀ ਤੁਸੀਂ ਫੋਮ ਔਨਲਾਈਨ ਹੀ ਸਬਮਿਟ ਕਰੋਗੇ ਅਤੇ ਆਪਣੇ ਪਹਿਲਾਂ ਤੁਹਾਡਾ ਮਤਲਬ ਲੈਤਾ ਜਾਊਗਾ ਹੈ ਨਾ ਕਿ ਤੁਸੀਂ ਕਿਵੇਂ ਖੇਡਦੇ ਹੋ ਤੁਹਾਨੂੰ ਦੇਖਿਆ ਜਾਊਗਾ ਫਿਰ ਉਸ ਹਿਸਾਬ ਨਾਲ ਤੁਹਾਡੀ ਐਡਮਿਸ਼ਨ ਹੋਊਗੀ ਬੇਸੀਕਲੀ ਆਪਣੇ ਕੋਲ ਸਾਰੀਆਂ ਗੇਮਸ ਹੀ ਅਵੇਲੇਬਲ ਆ ਐਂਡ ਆਪਣੀਆਂ ਬਹੁਤ ਸਾਰੀਆਂ ਬਰਾਂਚਿਜ ਆ ਜਿਵੇਂ ਸੰਗਰੂਰ ਪਟਿਆਲੇ ਲੁਧਿਆਣੇ ਸਾਰੇ ਕਿਤੇ ਹੈਗੀਆਂ ਨੇ ਅਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਫਾਰਮ ਔਨਲਾਈਨ ਸਬਮਿਟ ਕਰੋਗੇ ਜੋ ਤੁਸੀਂ ਸਬਮਿਟ ਕਰ ਦਿੱਤਾ ਤਾਂ ਸਾਡੇ ਕੋਲ ਤੁਹਾਡਾ ਰਿਕਾਰਡ ਆ ਜਾਊਗਾ ਉਸ ਤੋਂ ਬਾਅਦ ਜੀ ਤੁਹਾਨੂੰ ਕਾਉਂਸਲਿੰਗ ਵਗੈਰਾ 'ਤੇ ਬੁਲਾਇਆ ਜਾਊਗਾ ਅਤੇ ਤੁਹਾਡਾ ਮਤਲਬ ਬਾਈਬਾ ਲਿਤਾ ਜਾਊਗਾ ਅਤੇ ਤੁਹਾਡੀ ਗੇਮ ਦੇਖੀ ਜਾਊਗੀ ਕਿ ਤੁਸੀਂ ਕਿਵੇਂ ਖੇਡਦੇ ਹੋ ਇਹ ਅਕੈਡਮੀ ਸੰਗਰੂਰ ਦੇ ਬਿਲਕੁਲ ਮਿਡ 'ਚ ਆ ਜੀ ਹਾਂਜੀ ਗਰਲਜ ਲਈ ਹੋਸਟਲਜ਼ ਪ੍ਰੋਵਾਈਡ ਕੀਤੇ ਜਾਂਦੇ ਨੇ ਜੀ ਐਂਡ ਦੇਖੋ ਗੇਮ 'ਤੇ ਡਿਪੈਂਡ ਆ ਵੈਸੇ ਤਾਂ ਸਵੇਰ ਅਤੇ ਸ਼ਾਮ ਤੱਕ ਸਾਰਿਆਂ ਦੀ ਪ੍ਰੈਕਟਿਸ ਹੁੰਦੀ ਆ ਜਿਵੇਂ ਸਵੇਰੇ ਇੱਕ ਗਰੁੱਪ ਲੱਗਦਾ ਐਂਡ ਸ਼ਾਮ ਨੂੰ ਗਰੁੱਪ ਲੱਗਦਾ ਬਟ ਦੁਪਹਿਰੇ ਅਸੀਂ ਨਹੀਂ ਇੰਨਾ ਕਰਦੇ ਕਿਉਂਕਿ ਗਰਮੀ ਬਹੁਤ ਹੋ ਜਾਂਦੀ ਆ ਐਂਡ ਇੱਕ ਗੱਲ ਹੋਰ ਕਿ ਜਿਹੜੇ ਫੋਨਸ ਉਹ ਸਟਰਿਕਟਲੀ ਮਨ੍ਹਾ ਨੇ ਅਤੇ ਬੱਚਿਆਂ ਨੂੰ ਸਾਰੇ ਡਾਊ ਡਾਇਟ ਪ੍ਰੋਪਰ ਦਿੱਤੀ ਜਾਂਦੀ ਆ ਐਂਡ ਜਿਹੜੇ ਆਪਣੇ ਖੇਡਾਂ ਨੇ ਉਹਨਾਂ ਨੂੰ ਬ ਸਾਰੇ ਲੈਵਲ ਤੱਕ ਬੱਚਿਆਂ ਨੂੰ ਲਿਆ ਜਾਂਦਾ ਜੋ ਜਿੱਥੋਂ ਤੱਕ ਡਿਜਰਵ ਕਰਦਾ ਉਹਨੂੰ ਉੱਥੇ ਤੱਕ ਪਹੁੰਚਾਇਆ ਜਾਂਦਾ ਦੇਖੋ ਦਸ ਹਜ਼ਾਰ ਸਾਲ ਦਾ ਪੈਂਦਾ ਕਿਉਂਕਿ ਇਹ ਸਰਕਾਰੀ ਆ ਤਾਂ ਕਰਕੇ ਐਂਡ ਬੱਸ ਬੱਸ ਦਾ ਤੁਹਾਡਾ ਲਾ ਲੂ ਕੇ ਬੱਚੇ ਦਾ ਹਜ਼ਾਰ ਦੋ ਹਜ਼ਾਰ ਰੁਪਇਆ ਪੈ ਜਾਂਦਾ ਓ ਮਹੀਨੇ ਦਾ ਦੇਖੋ ਬੱਚਿਓ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹ ਸਰਕਾਰੀ ਕਾਲਜ ਆ ਤਾਂ ਬੱਚਿਆਂ ਦੀ ਵੀ ਮਤਲਬ ਪੰਜ ਸੌ ਤੱਕ ਬੱਚੇ ਹੈ ਇੱਥੇ ਹਾਂਜੀ ਤਾਂ ਬੱਚੇ ਤੁਸੀਂ ਔਨਲਾਈਨ ਭਰ ਓਕੇ ਓਕੇ